ਮੇਰਾ ਮਨਪਸੰਦ ਲਿਖਣ ਵਾਲਾ ਸ਼ਿਵ ਕੁਮਾਰ ਬਟਾਲਵੀ ਹੈ ਜਿਸਨੂੰ ਬਿਰਹਾ ਦਾ ਸੁਲਤਾਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਦੀਆਂ ਮਸ਼ਹੂਰ ਕ ਕਿਤਾਬਾਂ ਇਹ ਹਨ ਆਟੇ ਦੀਆਂ ਚਿੜੀਆਂ ਬਿਰਹਾ ਤੂੰ ਸੁਲਤਾਨ ਲੂਣਾ ਅਤੇ ਮੈਨੂੰ ਵਿਦਾ ਕਰੋ ਲੂਣਾ ਦੇ ਵਿੱਚ ਔਰਤ ਦੀ ਤ੍ਰਾਸ਼ਦੀ ਨੂੰ ਪ੍ਰਗਟ ਕੀਤਾ ਗਿਆ ਹੈ ਅਤੇ ਔਰਤ ਦੇ ਨਾਲ ਹੁੰਦੇ ਅਨਿਆਂ ਨੂੰ ਪੇਸ਼ ਕੀਤਾ ਗਿਆ ਹੈ ਅਤੇ ਉਨ੍ਹਾਂ ਦੀਆਂ ਮਸ਼ਹੂਰ ਲਾਈਨਾਂ ਜੋ ਮੈਨੂੰ ਬਹੁਤ ਪਸੰਦ ਹਨ ਉਹ ਹਨ ਕੀ ਪੁੱਛਦਿਉ ਹਾਲ ਫ਼ਕੀਰਾਂ ਦਾ ਸਾਡਾ ਨਦੀਓਂ ਵਿਛੜੇ ਨੀਰਾਂ ਦਾ ਸਾਡਾ ਹੰਝ ਦੀ ਜੂਨੇ ਆਇਆਂ ਦਾ ਸਾਡਾ ਦਿਲ ਜਲਿਆਂ ਦਿਲਗੀਰਾਂ ਦਾ